ਵਧੀਆ ਵਧੀਆ ਵੀਰੇ ਤੁਸੀਂ ਦੱਸੋ ਠੀਕ ਆ ਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਮੋਦੀ ਕੋਲਜ ਦੇ ਨੇੜੇ ਤੇੜੇ ਜੀ ਬਸ ਠੀਕ ਆ ਫਿਰ ਭਾਅ ਜੀ ਤੁਸੀਂ ਦੇਖੋ ਤੁਹਾਨੂੰ ਬਾਈ ਨੰਬਰ ਪੀ ਜੀ ਦਵਾ ਦੂੰਗਾ ਇੱਕ ਨਾ ਪੀ ਜੀ ਬਾਈ ਨੰਬਰ ਮੇਰੇ ਕੋਲ ਨੋਨ ਦੇ ਵਿੱਚ ਕਾਫੀ ਦੋਸਤ ਰਹਿੰਦੇ ਆ ਅਤੇ ਪੀਜੀ ਪੀ ਜੀ ਇਨ ਦਾ ਸੈਂਸ ਆਂਯਾ ਤੁਹਾਨੂੰ ਕੋਠੀ ਪੈ ਜਾਏ ਪੂਰੀ ਦੀ ਪੂਰੀ ਪੈ ਜਾਵੇ ਅਤੇ ਕੋਠੀ ਦੇ ਵਿੱਚ ਐਂ ਤੁਹਾਨੂੰ ਅੱਡ ਕਮਰਾ ਮਿਲ ਜਾਉ ਤੁਹਾਡਾ ਆਪਣਾ ਤੁਸੀਂ ਉੱਥੇ ਕੋਈ ਵੀ ਪੂਰੀ ਕੋ ਪੂਰੀ ਪੂਰੀ ਕੋਠੀ ਦਾ ਜੀ ਪੂਰੀ ਕੋਠੀ ਦਾ ਪੂਰੀ ਕੋਠੀ ਦਾ ਕਿਰਾਇਆ ਜੀ ਦੋਖੋ ਦਸ ਹਜ਼ਾਰ ਰੁਪਿਆ ਓ ਪ ਦੋ ਮਤਲਬ ਇੱਕ ਫਲੋਰ ਥੱਲੇ ਆ ਅਤੇ ਇੱਕ ਫਲੋਰ ਉੱਤੇ ਆ ਦੋ ਫਲੋਰਾਂ ਦਾ ਹੈਗਾ ਅਤੇ ਉਹਦਾ ਦਸ ਹਜ਼ਾਰ ਰੁਪਿਆ ਕਿਰਾਇਆ ਅਤੇ ਉਹਦੇ ਵਿੱਚ ਬਿਜਲੀ ਦਾ ਬਿੱਲ ਅੱਡ ਆਊਗਾ ਅਤੇ ਬਿਜਲੀ ਦਾ ਬਿਲ ਅੱਡ ਆਊਗਾ ਉਹ ਤੁਹਾਨੂੰ ਅੱਡ ਆਪਣਾ ਭਰਨਾ ਪੈਣਾ ਅਤੇ ਰਹਿਣ ਸਹਿਣ ਦੀ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਤੁਸੀਂ ਜਿਹਨੂੰ ਮਰਜ਼ੀ ਲਿਆ ਸਿਆ ਸਕਦੇ ਹੋ ਕੋਈ ਫਿਰ ਕੋਈ ਮਰਜ਼ੀ ਰਖਾ ਲਓ ਅਤੇ ਹਾਂਜੀ ਹਾਂਜੀ ਉਹ ਤੂੰ ਦੇਖੋ ਜੀ ਤੁਸੀਂ ਪਹਿ ਚ ਜੇ ਤੁਸੀਂ ਰਹਿਣਾ ਹੀ ਇਕੱਲੇ ਜਾਣੇ ਨੇ ਫਿਰ ਤੁਸੀਂ ਪੂਰੀ ਦੀ ਪੂਰੀ ਕੋਠੀ ਲੈ ਕੇ ਕੀ ਕਰਨਾ ਜੀ ਜੇ ਤੁਸੀਂ ਇੱਕ ਆਪਣਾ ਉੱਪਰਲੇ ਪਾਸੇ ਉਹ ਕਮਰਾ ਦੇਖ ਲਓ ਉਹ ਤੁਹਾਨੂੰ ਸਿਰਫ ਰੈਂਟ ਗਿਆਰਾਂ ਸੌ ਗਿਆਰਾਂ ਹਜ ਉਹ ਚਾਰ ਹਜ਼ਾਰ ਰੁਪਇਆ ਪੈ ਜਾਣਾ ਮਹੀਨੇ ਦਾ ਨਾ ਨਾ ਕੋਈ ਦਿੱਕਤ ਨਹੀਂ ਜਿਵੇਂ ਤਾਂ ਤੁਹਾਡਾ ਹੀ ਕਮਰਾ ਹੋਊਗਾ ਉਹ 'ਚ ਜੋ ਮਰਜ਼ੀ ਕਰੋ ਜਿਵੇਂ ਮਰਜ਼ੀ ਕੋਈ ਮਰਜ਼ੀ ਲੈ ਕੇ ਆਓ ਤੁਹਾਡੀ ਕੋਈ ਰੋਕ ਟੋਕ ਨਹੀਂ ਹੋਣੀ ਉਹ ਤੁਹਾਡਾ ਆਪਣਾ ਹੀ ਹੋਣਾ ਉਹ ਹਾਂਜੀ ਹਾਂਜੀ ਅਤੇ ਇਹ ਬਾਈ ਨੰਬਰ ਆ ਜੀ ਬਾਈ ਨੰਬਰ 'ਤੇ ਸਾਊਥ 'ਤੇ ਜਮ੍ਹਾਂ ਜਿਹੜੀ ਸਾਹਨੀ ਸਵੀਟਸ ਆ ਸਾਹਨੀ ਬੇਕਰੀ ਆ ਸਾਹਨੀ ਬੇਕਰੀ ਦੇ ਪਿੱਛੇ ਹੀ ਇਹੀ ਆ ਤੁਸੀਂ ਬਸ ਮੈਨੂੰ ਸਾਹਨੀ ਬੇਕਰੀ ਆ ਕੇ ਮਿਲਿਓ ਮੈਂ ਤੁਹਾਨੂੰ ਫੋਨ ਕਰ ਦੂੰਗਾ ਅਤੇ ਤੁਸੀਂ ਮੈਨੂੰ ਮੇ ਮਿਲ ਲਿਓ ਬਸ ਹਾਂਜੀ ਹਾਂਜੀ ਮੋਦੀ ਕੋਲਜ ਦੇ ਨੇੜੇ ਦੇਖੋ ਤੁਹਾਨੂੰ ਮੋਦੀ ਕੋਲਜ ਦੇ ਨੇੜੇ ਤਾਂ ਇੱਕ ਉੱਥੇ ਹੈਗਾ ਜੀ ਜੇ ਤੁਹਾਨੂੰ ਮੈਂ ਦੱਸਾਂ ਜਿਹੜਾ ਪੋਲੋ ਗਰਾਉਂਡ ਆ ਨਾ ਪੋਲੋ ਪੋਲ ਯਾਦਵਿੰਦਰ ਵਾਲੀ ਸਾਈਡ ਪੋਲੋ ਗਰਾਊਂਡ ਵਾਲੀ ਸਾਈਡ ਉੱਥੇ ਤੁਹਾਨੂੰ ਮਿਲ ਜਾਣਾ ਇੱਕ ਹਾਂ ਉਹ ਉਹ ਪੋਲੋ ਗਰਾਉਂਡ ਦੇ ਕੋਲ ਤੁਹਾਨੂੰ ਉਹ ਪੈ ਜਾਣਾ ਆਪਾਂ ਨੂੰ ਬੜੇ ਆਰਾਮ ਨਾਲ ਉਹਦੀ ਵੀ ਛੇਮ ਰੇਂਜ ਹੀ ਹੁੰਦੀ ਆ ਉਹ ਤੁਹਾਨੂੰ ਕਲ ਉੱਥੇ ਕੱਲਾ ਕਮਰਾ ਮਿਲੇਗਾ ਅਤੇ ਮਤਲਬ ਉਹ ਜਿਵੇਂ ਇੱਕ ਅੱਡ ਹੀ ਪੀ ਜੀ ਛੱਤਿਆ ਹੋਇਆ ਬਸ ਉਹ ਅਤੇ ਉਹ ਉਹਦਾ ਰੇਟ ਹਾਂ ਆਪਾਂ ਨੂੰ ਮਤਲਬ ਪੈ ਓ ਪੰਤਾਲੀ ਸੌ ਰੁਪਇਆ ਪੈ ਜਾਣਾ ਹਾਂਜੀ ਹਾਂਜੀ ਹਾਂਜੀ ਪੂ ਕੱਲੇ ਕਮਰੇ ਦਾ ਬਿਜਲੀ ਦਾ ਬਿੱਲ ਹਾਂਜੀ ਹਾਂਜੀ ਬਿਜਲੀ ਦਾ ਬਿੱਲ ਸਾਰਿਆਂ 'ਚ ਅੱਡ ਆਉਂਦਾ ਜੀ ਉਹਦਾ ਕਮਰੇ ਦਾ ਥੋੜ੍ਹਾ ਐਂ ਕਮਰਾ ਥੋੜ੍ਹਾ ਜਿਹਾ ਨੇੜ ਕੋਲਜ ਦੇ ਨੇੜੇ ਆ ਉਸ ਚੀਜ਼ ਕਰਕੇ ਉਹਦੀ ਉਹ ਵੱਧ ਗਈ ਵੈਲਿਊ ਵੱਧ ਗਈ ਹਾਂਜੀ ਹਾਂਜੀ ਹਾਂਜੀ ਤਾਂ ਕਰਕੇ ਉਹ ਤੁਹਾਨੂੰ ਪੈ ਜਾਣਾ ਤੁਸੀਂ ਦੇਖ ਲਓ ਗੱਲ ਕਰਕੇ ਦੇਖ ਲਓ ਬਾਕੀ ਮੈਂ ਤੁਹਾਨੂੰ ਮਿਲਵਾ ਦੂੰਗਾ ਗੱਲ ਕਰਕੇ ਹੀ ਉਹ ਕਈ ਵਾਰ ਮੰਨ ਵੀ ਜਾਂਦੇ ਹੁੰਦੇ ਆ ਉਹ ਤਾਹੋ ਤਿੰਨ ਚਾਰ ਸੌ ਰੁਪਇਆ ਘਟਾ ਲੈਂਦੇ ਹੁੰਦੇ ਆ ਬਾਹਰ ਤੋਂ ਪੰਤਾਲੀ ਸੌ ਦਾ ਚਾਰ ਹਜ਼ਾਰ ਕਰ ਲੈਣਗੇ ਉਹ ਇੰਨਾ ਕੁ ਬਸ ਇੰਨੀ ਕੁ ਛੂਟ ਦੇ ਦਿੰਦੇ ਹੁੰਦੇ ਆ ਉਹ ਤਾਂ ਹੈ ਉਹ ਤਾਂ ਵੀਰੇ ਮੈਂ ਸਮਝਦਾ ਇਕੱਲੇ ਬੰਦੇ ਦਾ ਰਹਿਣਾ ਔਖਾ ਨਾ ਅਤੇ ਇਕੱਲੇ ਜਾਣੇ ਨੂੰ ਕਰਨਾ ਤਾਂ ਬੰਦੇ ਨੂੰ ਦਿੱਕਤ ਆਉਂਦੀ ਹੀ ਹੈ ਹਾਂਜੀ ਹਾਂਜੀ ਮੈਨੂੰ ਜ਼ਰੂਰ ਮਿਲ ਲਿਓ ਮੈਂ ਤੁਹਾਨੂੰ ਉਹ ਕਰ ਦੂਗਾ ਜ਼ਰੂਰ ਮਿਲ ਮੈਂ ਤੁਹਾਨੂੰ ਮਿਲ ਲਊਂਗਾ ਹਾਂਜੀ ਹਾਂਜੀ ਦੱਸ ਦੂੰਗਾ ਹਾਂਜੀ ਓਕੇ ਬਾਏ ਧੰਨਵਾਦ